ਮੇਰੇ ਮੁਤਾਬਿਕ ਖੇਡ ਇਕ ਬਹੁਤ ਵਧੀਆ ਚੀਜ਼ ਹੈ ਮੈਂ ਆਪ ਇੱਕ ਅਥਲੈਟਿਕਸ ਦਾ ਖਿਡਾਰੀ ਹਾਂ ਮੈਨੂੰ ਯਾਦ ਹੈ ਕਿ ਜਦੋਂ ਮੈਂ ਸਕੂਲ ਟਾਈਮ ਵਿੱਚ ਆਪਣੇ ਈਵੈਂਟ ਖੇਡਣ ਜਾਣਾ ਸੀ ਮੈਂ ਆਪਣੇ ਇੱਕ ਡਾਇਟ ਤਿਆਰ ਕੀਤੀ ਸੀ ਜਿਸ ਨਾਲ ਮੈਨੂੰ ਬਹੁਤ ਫਾਇਦਾ ਹੋਇਆ ਹੈ ਜਿਸ ਨੂੰ ਖਾ ਕੇ ਮੈਂ ਗਿ ਰੇਸ ਤਾਂ ਜਿੱਤਦਾ ਹੀ ਜਿੱਤਦਾ ਜਿਸ ਨਾਲ ਮੈਂ ਰੇਸ ਵੀ ਜਿੱਤਦਾ ਹੀ ਜਿੱਤਦਾ ਤਾਂ ਉਹ ਅਤੇ ਉਸ ਨਾਲ ਮੈਨੂੰ ਸਰੀਰ ਦੇ ਵਿੱਚ ਤੰਦਰੁਸਤੀ ਵੀ ਪੈਦਾ ਹੋਈ ਹੈ ਖੇਡ ਇੱਕ ਇਹੋ ਜਿਹੀ ਚੀਜ਼ ਹੈ ਜਿਹੜਾ ਬੰਦੇ ਦਾ ਸਰੀਰ ਨਰੋਇਆ ਰੱਖਦੀ ਹੈ ਮੈਂ ਜਦੋਂ ਹੰਡਰਡ ਮੀਟਰ ਰੇਸ ਦੋੜਿਆ ਸੀ ਅਤੇ ਮੈਨੂੰ ਬਿਲਕੁਲ ਵੀ ਨਹੀਂ ਥਕਾਨ ਹੋਈ ਸੀ ਮੈਂ ਡਾਇਟ ਦੇ ਵਿੱਚ ਡਾਇਟ ਤਾਂ ਬਹੁਤ ਮਨੁੱਖੀ ਚੀਜ਼ ਹੈ ਇਹ ਖੇਡ ਵਿੱਚ ਅਤੇ ਐਥਲੈਟਿਕਸ ਇਹ ਇੱਕ ਇਹੋ ਜਿਹੀ ਚੀਜ਼ ਹੈ ਜਿਸ ਨਾਲ ਡਾਇਟ ਬਿਨਾਂ ਅਧੂਰਾ ਹੈ ਖੇਡ ਇੱਕ ਇਹੋ ਜਿਹੀ ਚੀਜ਼ ਹੈ ਜਿਸ ਨਾਲ ਬੰਦਾ ਨਰੋਇਆ ਰਹਿੰਦਾ ਹੈ ਅਤੇ ਉਸ ਨੂੰ ਜੀਵਨ ਦੀ ਟੈਂਸ਼ਨ ਵੀ ਖ਼ਤਮ ਹੋ ਜਾਂਦੀ ਹੈ ਖੇਡਦੇ ਜੀਵਨ ਖੇਡਾਂ ਵਿੱਚ ਜੀਵਨ ਦੇ ਹਰ ਇੱਕ ਸਾਝ ਹੁੰਦੀ ਹੈ ਜਿਸ ਨਾਲ ਬੰਦਾ ਨਰੋਇਆ ਵੀ ਰਹਿੰਦਾ ਹੈ ਅਤੇ ਉਸ ਨੂੰ ਤੰਦਰੁਸਤੀ ਵੀ ਮਹਿਸੂਸ ਹੁੰਦੀ ਹੈ